ਸਰਕਾਰੀ ਪਹਿਲਕਦਮੀਆਂ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਮੇਰੇ ਧਿਆਨ ਦੇ ਵਿੱਚ ਜਿਹੜਾ ਆਉਂਦਾ ਆ ਉਹ ਲੋਕਾਂ ਦੀ ਸਿਹਤ ਹੁੰਦੀ ਹੈ ਕਿਸੇ ਵੀ ਸਰਕਾਰ ਨੂੰ ਆਪਣੀ ਆਪਣੇ ਲੋਕਾਂ ਦੇ ਪ੍ਰਤੀ ਉਹਨਾਂ ਦੀ ਸਿਹਤ ਦੇ ਪ੍ਰਤੀ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਸਰਕਾਰੀ ਹਸਪਤਾਲ ਬਣਾਉਣੇ ਚਾਹੀਦੀ ਹੈ ਜਿਨਾਂ ਦੇ ਵਿੱਚ ਇਲਾਜ ਮੁਕ ਮੁਫਤ ਹੋਵੇ ਔਰ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਲੋਕਾਂ ਨੂੰ ਦਿੱਤੀ ਜਾਵੇ ਜਿਹੜੇ ਗਰੀਬ ਲੋਕ ਹੁੰਦੇ ਨੇ ਉਹਨਾਂ ਦਾ ਇਲਾਜ ਮੁਫਤ ਹੋਵੇ ਕੋਈ ਫੀਸ ਨੀ ਹੋਵੇ ਕੋਈ ਉਹਨਾਂ ਨੂੰ ਦਵਾਈ ਜਿਹੜੀ ਵੀ ਚਲਦੀ ਆ ਉਹਨਾਂ ਲਈ ਮੁਫਤ ਹੋਵੇ ਦੂਜੀ ਜਿਹੜੀ ਚੀਜ਼ ਹੁੰਦੀ ਹੈ ਉਹ ਹੁੰਦੀ ਹੈ ਕਿ ਸਮਾਜਿਕ ਤੇ ਆਰਥਿਕ ਜਿਹੜੀ ਐ ਉਹ ਵੈਲਫੇਅਰ ਦੇ ਬਾਰੇ ਕੰਮ ਕਰਨਾ ਚਾਹੀਦਾ ਸਰਕਾਰ ਨੂੰ ਆਰਥਿਕ ਸਥਿਤੀ ਅਗਰ ਲੋਕਾਂ ਦੀ ਠੀਕ ਹੋਵੇਗੀ ਤਾਂ ਉਹੀ ਲੋਕੀ ਜਿਹੜੇ ਨੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਸਕਣਗੇ ਆਰਥਿਕ ਔਰ ਸਮਾਜਿਕ ਤੌਰ 'ਤੇ ਜੇ ਲੋਕਾਂ ਨੂੰ ਕੀ ਕਹਿੰਦੇ ਇਕੁਐਲਟੀ ਮਿਲੇਗੀ ਤਾਂ ਉਹ